ਗਾਉਣ ਦੇ ਮਨਪਸੰਦ ਗੀਤਾਂ ਵਿੱਚ ਮੈਨੂੰ ਗੁਰਦਾਸ ਮਾਨ ਦਾ ਗਾਇਆ ਹਰ ਗਾਣਾ ਬਹੁਤ ਪਸੰਦ ਹੈ ਕਿਉਂਕਿ ਉਹਨਾਂ ਗੀਤਾਂ ਵਿੱਚ ਬਹੁਤ ਅਸਲੀਅਤ ਹੁੰਦੀ ਹੈ ਕੁਝ ਗਾਣੇ ਜਿੱਦਾਂ ਕਿ ਰੋਟੀ ਛੱਲਾ ਇਹਨਾਂ ਵਿੱਚ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਨੂੰ ਦਰਸ਼ਾਇਆ ਵੀ ਜਾਂਦਾ ਹੈ ਅਤੇ ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਇਹ ਬਹੁਤ ਹੀ ਸਭਯ ਗਾਣੇ ਹੁੰਦੇ ਹਨ ਅਤੇ ਹਰ ਕੋਈ ਆਪਣੇ ਪਰਿਵਾਰ ਨਾਲ ਬੈਠ ਕੇ ਸੁਣ ਸਕਦਾ ਹੈ ਜਿਹਨਾਂ ਵਿੱਚ ਕੋਈ ਮਤਲਬ ਨਿਕਲਦਾ ਹੈ ਅਤੇ ਜਿਹਦਾ ਕੋਈ ਫਾਇਦਾ ਹੁੰਦਾ ਹੈ